ਸਟੈਂਪਾਂ ਅਤੇ ਸਿੱਖਿਆਂ ਨੂੰ ਇਕੱਠੇ ਸਿੱਕਿਆਂ ਨੂੰ ਇਕੱਠਾ ਕਰਨ ਦਾ ਆਪਣਾ ਹੀ ਇੱਕ ਵਿਦਿਅਕ ਮੁੱਲ ਹੈ ਇਸ ਤੋਂ ਸਾਨੂੰ ਪਿਛਲੇ ਸਮੇਂ ਦੇ ਸਟੈਂਪਾਂ ਅਤੇ ਸਿੱਕਿਆਂ ਦੀ ਜਾਣਕਾਰੀ ਪ੍ਰਾਪਤ ਹੁੰਦੀ ਹੈ ਜੇਕਰ ਅਸੀਂ ਸਟੈਂਪਾਂ ਦੀ ਗੱਲ ਕਰੀਏ ਤਾਂ ਇਹਨਾਂ ਤੋਂ ਪਤਾ ਲੱਗਦਾ ਹੈ ਕਿ ਡਾਕਖਾਨੇ ਵਿੱਚੋਂ ਆਈਆਂ ਚਿੱਠੀਆਂ ਕਾਨੂੰਨੀ ਹਨ ਜਾਂ ਗੈਰ ਕਾਨੂੰਨੀ ਹਨ ਹਰੇਕ ਹਰੇਕ ਹਰੇਕ ਡਾਕਖਾਨੇ ਦੀ ਆਪਣੀ ਆਪਣੀ ਅਲੱਗ ਅਲੱਗ ਸਟੈਂਪ ਹੋ ਸਕਦੀ ਹੈ ਅਤੇ ਉਹਨਾਂ ਦਾ ਡਿਜ਼ਾਇਨ ਉਹਨਾਂ ਦਾ ਕਲਰ ਵੀ ਅਲੱਗ ਹੋ ਸਕਦਾ ਹੈ ਹਰੇਕ ਦੇਸ਼ ਵਿੱਚ ਇਹਨਾਂ ਦਾ ਅਲੱਗ ਡਿਜ਼ਾਇਨ ਅਤੇ ਕਲਰ ਹੁੰਦਾ ਹੈ ਹਰੇਕ ਦੇਸ਼ ਦੀ ਆਪਣੀ ਆਪਣੀ ਅਲੱਗ ਅਲੱਗ ਸਟੈਂਪ ਹੋ ਸਕਦੀ ਹੈ ਅਤੇ ਸਿੱਕਿਆਂ ਨੂੰ ਇਕੱਠਾ ਕਰਨ ਨਾਲ ਬਹੁਤ ਹੀ ਜਾਣਕਾਰੀ ਪ੍ਰਾਪਤ ਹੁੰਦੀ ਹੈ ਇਸ ਤੋਂ ਸਾਨੂੰ ਪਿਛਲੇ ਸਮੇਂ ਦੇ ਸਿੱਕਿਆਂ ਅਤੇ ਹੁਣ ਦੇ ਸਿੱਕਿਆਂ ਵਿੱਚ ਕਿਆ ਅੰਤਰ ਹੈ ਇਸ ਬਾਰੇ ਪਤਾ ਲੱਗਦਾ ਹੈ ਅਤੇ ਇਸ ਨਾਲ ਅਸੀਂ ਪੁਰਾਣੇ ਸਮਿਆਂ ਦੇ ਸਿੱਕਿਆਂ ਅਤੇ ਹੁਣ ਦੇ ਸਿੱਕਿਆਂ ਦੀ ਤੁਲਨਾ ਕਰ ਸਕਦੇ ਹਾਂ ਉਹਨਾਂ ਦੇ ਉਹਨਾਂ ਦੇ ਕਲਰ ਉਹਨਾਂ ਦੇ ਜੋ ਰੰਗ ਉਹਨਾਂ ਦਾ ਕੀਮਤ ਉਸ ਸਮੇਂ ਵਿੱਚ ਕਿੰਨੀ ਸੀ ਅਤੇ ਅੱਜ ਉਹਨਾਂ ਦੀ ਕੀ ਵੈਲਿ ਕੀ ਕੀਮਤ ਹੈ ਇਸ ਦਾ ਸਾਨੂੰ ਗਿਆਨ ਪ੍ਰਾਪਤ ਹੁੰਦਾ ਹੈ ਅਤੇ ਉਸ ਸਮੇਂ ਦੇ ਸਿੱਕਿਆਂ ਅਤੇ ਅੱਜ ਦੇ ਸਿੱਕਿਆਂ ਵਿੱਚ ਅੰਤਰ ਕਰਨ ਲਈ ਇਹਨਾਂ ਦਾ ਬਹੁਤ ਹੀ ਮਹੱਤਵਪੂਰਨ ਯੋਗਦਾਨ ਹੈ